ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਉਹ ਅੱਜ ਸਾਡੀ ਡਾਂਸ ਦੀ ਕਲਾਸ ਹੈਗੀ ਆ ਅਤੇ ਸਰ ਪਿਛਲੀ ਵਾਰ ਜਿਹੜਾ ਅਸੀਂ ਜਿੱਦਾਂ ਭੰਗੜਾ ਕੀਤਾ ਸੀਗਾ ਅਤੇ ਉਹ ਤਾਂ ਅੱਧਾ ਰਹਿ ਗਿਆ ਸੀਗਾ ਅਤੇ ਅੱਜ ਸੋਚਦੇ ਹਾਂ ਕਿ ਉਹੀ ਜਿਹੜਾ ਅੱਧਾ ਰਹਿ ਗਿਆ ਸੀ ਉਹ ਵੀ ਅੱਜ ਪੂਰਾ ਕਰ ਲੈਦੇ ਹਾਂ ਸਰ ਪੈਨ ਡਰਾਈਵ ਤਾਂ ਉਹ ਤਾਂ ਘਰ ਰਹਿ ਗਈ ਵੀ ਆ ਸਰ ਫਿਰ ਸਰ ਫ ਫੋਨ 'ਤੇ ਲਾ ਲਵਾਂਗੇ ਨਹੀਂ ਤਾਂ ਮੈਂ ਕਿਹਾ ਫੋਨ 'ਤੇ ਲਾ ਲੈਂਦੇ ਹਾਂ ਨਹੀਂ ਤਾਂ

ਹਾਂਜੀ ਹਾਂਜੀ ਸਰ ਇਹ ਵੀ ਹੈ ਸਰ ਨਹੀਂ ਤਾਂ ਮੈਂ ਆਪਣੇ ਫਰੈਂਡ ਕੋਲੋਂ ਪੁੱਛਦਾ ਕਿ ਉਹਨੇ ਲਿਆਂਦੀ ਵੀ ਹੈ ਕਿ ਨਹੀਂ ਸਰ ਫਿਰ ਤਾਂ ਪ ਪ੍ਰਿੰਸੀਪਲ ਸਰ ਕੋਲੋਂ ਪਰਮਿਸ਼ਨ ਲੈਣੀ ਪੈਣੀ ਹੈ ਜੇ ਉਹ ਕਹਿਣਗੇ ਜਾਓ ਤੁਹਾਨੂੰ ਪਤਾ ਟਰੈਫਿਕ ਵੀ ਚੱਲਦੀ ਹੈ ਫਿਰ ਤਾਂ ਕਰਕੇ ਉਹਨਾਂ ਨੇ ਜਾਣ ਨਹੀਂ ਦੇਣਾ ਸਾਨੂੰ ਪ ਪੈਨ ਡਰਾਈਵ ਲਿਆਉਣ ਘਰ ਠੀਕ ਹੈ ਠੀਕ ਹੈ ਓਕੇ ਸਰ ਆ ਗਏ ਹਾਂ ਫਿਰ ਅਸੀਂ ਠੀਕ ਥੈਂਕ ਯੂ ਸਰ ਠੀਕ ਹੈ ਸਰ ਠੀਕ ਹੈ ਥੈਂਕ ਯੂ ਸਰ